ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਦੋ ਅਕਤੂਬਰ ਦੋ ਹਜ਼ਾਰ ਚੌਦਾਂ ਯਾਨੀ ਕਿ ਗਾਂਧੀ ਜਯੰਤੀ ਵਾਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੀਤੀ ਸੀ ਇਸ ਰਾਹੀਂ ਉਹਨਾਂ ਨੇ ਸਾਡੇ ਸਮਾਜ ਵਿੱਚ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਸੀ ਅਤੇ ਅਸੀਂ ਉਹਨਾਂ ਨੇ ਸਾਨੂੰ ਦਰਸਾਇਆ ਸੀ ਕਿ ਸਫਾਈ ਸਾਡੇ ਸਫਾਈ ਸਾਨੂੰ ਆਪਣੇ ਆਲੇ ਦੁਆਲੇ ਦੀ ਜ਼ਰੂਰ ਰੱਖਣੀ ਚਾਹੀਦਾ ਹੈ ਕਿਉਂਕਿ ਜੇ ਅਗਰ ਅਸੀਂ ਸਫਾਈ ਨਹੀਂ ਰੱਖਾਂਗੇ ਤਾਂ ਸਾਡੇ ਆਲੇ ਦੁਆਲੇ ਵਿੱਚ ਗੰਦਗੀ ਹੋਵੇਗੀ ਅਤੇ ਗੰਦਗੀ ਵਿੱਚ ਹੀ ਬਿਮਾਰੀਆਂ ਪਣਪਦੀਆਂ ਹਨ ਕਿਵੇਂ ਕਿ ਹੈਜਾ ਜਾਂ ਮੱਛਰਾਂ ਰਾਹੀਂ ਮਲੇਰੀਆ ਤੇਹਜ ਖੜ੍ਹੇ ਪਾਣੀ ਰਾਹੀਂ ਜੋ ਮੱਛਰ ਰਾਹੀਂ ਮਲੇਰੀਆ ਹੁੰਦਾ ਅਤੇ ਇਸ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਹੁੰਦੀਆਂ ਹਨ ਅਤੇ ਅਸੀਂ ਜੇ ਸਫਾਈ ਮੁਹਿੰਮ ਦੀ ਗੱਲ ਕਰੀਏ ਤਾਂ ਸਾਡੇ ਸ਼ਹਿਰ ਜ਼ਿਲ੍ਹਾ ਕਪੂਰਥਲਾ ਵਿੱਚ ਹਰੇਕ ਮਹੀਨੇ ਹੀ ਸਫਾਈ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਮੈਂ ਵੀ ਉਹਨਾਂ ਵਿੱਚ ਹਿੱਸਾ ਪਾਉਂਦਾ ਹਾਂ ਕਿਉਂਕਿ ਸਾਡੇ ਸ਼ਹਿਰ ਵਿੱਚ ਮਿਊਨਸੀਪਲ ਕਾਰਪੋਰੇਸ਼ਨ ਹੋਣ ਕਾਰਨ ਕਈ ਵਾਰ ਹੜਤਾਲਾਂ ਵੀ ਹੋ ਜਾਂਦੀਆਂ ਹਨ ਅਤੇ ਹੜਤਾਲਾਂ ਹੋਣ ਕਾਰਨ ਸੜ੍ਹਕ ਉੱਤੇ ਥਾਂ ਥਾਂ 'ਤੇ ਲਿਫਾਫੇ ਜਾਂ ਗੰਦਗੀ ਭਰੀ ਜਾਨ ਭਰੀ ਰਹਿੰਦੀ ਹੈ ਅਤੇ ਅਸੀਂ ਇੱਕ ਸੈਲਫ ਹੈਲਪ ਗਰੁੱਪ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਅਸੀਂ ਸਾਰੇ ਇਕੱਠੇ ਹੋ ਗਏ ਵਲੰਟੀਅਰ ਉਸ ਦਿਨ ਜਦੋਂ ਸਫਾਈ ਕਰਮਚਾਰੀ ਹੜਤਾਲ 'ਤੇ ਹੁੰਦੇ ਹਨ ਅਤੇ ਅਸੀਂ ਆਪਣੇ ਸ਼ਹਿਰ ਵੀ ਨੂੰ ਸਾਫ਼ ਸੁਥਰਾ ਰੱਖਣ ਲਈ ਏ ਇੱਕ ਲਾਮਬੰਦ ਹੁੰਦੇ ਹਨ ਅਤੇ ਅਸੀਂ ਸਾਰੇ ਜਣੇ ਰਲ ਕੇ ਲਗਭਗ ਦਸ ਪੰਦਰਾਂ ਜਣਿਆਂ ਦਾ ਗਰੁੱਪ ਅਤੇ ਅਸੀਂ ਇੱਕ ਟਰਾਲੀ ਲੈ ਕੇ ਟਰੈਕਟਰ ਟਰਾਲੀ ਲੈ ਕੇ ਸਫਾਈ ਕਰਦੇ ਹਾਂ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਕਰਨ ਵਿੱਚ ਹਿੱਸਾ ਪਾਉਂਦੇ ਹਾਂ ਅਤੇ ਅਸੀਂ ਜੇ ਸੁਧਾਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਾਨੂੰ ਜੋ ਸਫਾਈ ਕਰਮਚਾਰੀ ਆ ਉਹਨਾਂ ਦੀ ਤਨਖਾਹ ਭੱਤੇ ਥੋੜ੍ਹੇ ਜਿਹੇ ਵਧਾਉਣੇ ਚਾਹੀਦੇ ਹਨ ਅਤੇ ਉਹਨਾਂ ਉਹਨਾਂ ਦੀ ਵੀ ਜੋ ਰੋਜੀ ਰੋਟੀ ਚੱਲਦੀ ਉਹ ਅਤੇ ਇਸ ਰਾਹੀਂ ਚੱਲਦੀ ਹੈ ਅਤੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਹੋਰ ਗੱਲਾਂ ਦੀ ਜੇ ਗੱਲ ਕਰੀਏ ਤਾਂ ਸਾਨੂੰ ਹਰੇਕ ਸ਼ਹਿਰ ਜਾਂ ਜ਼ਿਲ੍ਹੇ ਵਿੱਚ ਇੱਕ ਵੇਸਟ ਟੂ ਮਟੀਰੀਅਲ ਵਾਲਾ ਪਲਾਂਟ ਖੋਲ੍ਹਣਾ ਚਾਹੀਦਾ ਹੈ ਜਾਂ ਤਾਂ ਜੋ ਜੋ ਜਿੰਨਾ ਵੀ ਗੰਦਗੀ ਹੈ ਅਤੇ ਉਹਨਾਂ ਵਿੱਚ ਵੇਸਟ ਮਟੀਰੀਅਲ ਰਾਹੀਂ ਕੁਛ ਨਾ ਕੁਛ ਤਿਆਰ ਕੀਤਾ ਜਾ ਸਕੇ ਅਤੇ ਅਸੀਂ ਆਪਣੀ ਜੀ ਡੀ ਪੀ ਵਿੱਚ ਵੀ ਹਿੱਸਾ ਪਾ ਸਕਦੇ ਹਾਂ ਅਤੇ ਜੋ ਸਾਡਾ ਗੰਦਾ ਪਾਣੀ ਹੈ ਉਹਨਾਂ ਦੀ ਨਿਕਾਸੀ ਬਾਰੇ ਵੀ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪਾਣੀ ਦੇ ਪਾਣੀ ਸਾਫ਼ ਕਰਨੇ ਵਾਲੇ ਟਰੀਟਮੈਂਟ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਣੀ ਸਾਫ਼ ਕਰਕੇ ਉਹਨਾਂ ਨੂੰ ਨਦੀਆਂ ਨਾਲਿਆਂ ਵਿੱਚ ਦੁਬਾਰਾ ਵਹਾਅ ਲਈ ਤੋਰਿਆ ਜਾ ਸਕੇ ਜਿਵੇਂ ਕਿ ਸਤਲੁਜ ਦਰਿਆ ਵਿੱਚ ਬਹੁਤ ਜ਼ਿਆਦਾ ਗੰਦਗੀ ਹੋ ਗਈ ਹੈ ਜਾਂ ਅਗਰ ਜਦੋਂ ਇਹ ਲੁਧਿਆਣਾ ਪਾਸ ਕਰਦਾ ਹੈ ਤਾਂ ਬਹੁਤ ਜ਼ਿਆਦਾ ਗੰਦਗੀ ਹੋ ਜਾਂਦੀ ਹੈ ਅਤੇ ਅਸੀਂ ਉਹਨਾਂ ਨੂੰ ਉੱਥੇ ਵਾਟਰ ਟਰੀਟਲਮੈਂਟ ਪਲਾਂਟ ਖੋਲ੍ਹਣੇ ਚਾਹੀਦੇ ਹਨ